ਗਿਆਰਾਂ ਦੋ ਦੋ ਹਜ਼ਾਰ ਤਿੰਨ ਪੰਦਰਾਂ ਪੰਜ ਦੋ ਹਜ਼ਾਰ ਇੱਕ ਸੋਲ੍ਹਾਂ ਅੱਠ ਦੋ ਹਜ਼ਾਰ ਪੰਜ ਤੀਹ ਇੱਕ ਦੋ ਹਜ਼ਾਰ ਦੋ ਪੰਦਰਾਂ ਸੱਤ ਦੋ ਹਜ਼ਾਰ ਦੋ